ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਕਿਆ ਹਾਲ ਹੈ ਜੀ ਠੀਕ ਹੈ ਜੀ ਤੁਸੀਂ ਦੱਸੋ ਕਿਆ ਹਾਲ ਹੈ ਬੱਚੇ ਠੀਕ ਹੈ ਅੱਛਾ ਜੀ ਬਾਹਰ ਜਾਣਾ ਪੜ੍ਹ ਲਏ ਹੋਰ ਤੁਸੀਂ ਅੱਛਾ ਜੀ ਬੱਚੇ ਠੀਕ ਹੈ ਅੱਛਾ ਜੀ ਬਾਹਰ ਜਾ ਕੇ ਕਿਆ ਕਰਨਾ ਬਾਹਰ ਜਾ ਕੇ ਕਿਆ ਕਰਨਾ ਉੱਥੇ ਕਿਆ ਕੰਮ ਹੈ ਆਹੀ ਕੰਮ ਹੈ ਬਸ ਗੱਡੀਆਂ ਗੁੱਡੀਆਂ ਧੋਣ ਦਾ ਹੋਰ ਕੋਈ ਝਾੜੂ ਪੋਚੇ ਹੋਰ ਇਹੀ ਕੰਮ ਹੈ ਉੱਥੇ ਵੀ ਕਿਆ ਕਰਨਾ ਸੋਰੀ ਉੱਥੇ ਤਾਂ ਕਰੂਗੇ ਇੱਧਰ ਨਹੀਂ ਕਰਨੇ ਹੈ ਹੋਰ

ਬਸ ਬੇਟੇ ਤਾਂ ਕੁਛ ਨਹੀਂ ਕਰਦੇ ਉਹ ਵੀ ਬਾਹਰ ਏ ਕਹਿੰਦੇ ਵੀ ਜਾਣਾ ਏ ਉਨ੍ਹਾਂ ਨੂੰ ਕਿਹਾ ਵੀ ਇੱਥੇ ਹੀ ਕਰ ਲਉ ਉੱਥੇ ਕਿਆ ਰੱਖਿਆ ਬਾਹਰ ਅੱਛਾ ਜੀ ਉੱਥੇ ਕਿਆ ਕਰਨਾ ਆ ਫਿਰ ਸਾਡੀ ਸੇਵਾ ਕੌਣ ਕਰੂ ਬਜ਼ੁਰਗਾਂ ਦੀ ਤੁਹਾਡੇ ਵੀ ਕਹਿੰਦੇ ਜਾਣ ਨੂੰ ਸਾਡੇ ਵੀ ਕਹਿੰਦੇ ਜਾਣ ਨੂੰ ਸਾਨੂੰ ਕੌਣ ਸਾਨੂੰ ਕੌਣ ਸਾਂਭੂੰਗਾ ਹੈਲੋ